ਮੈਂ ਮਿਸ਼ੋ ਤੋਂ ਦਸ ਦਿਨ ਪਹਿਲਾਂ ਹੈਡਫੋਨ ਮੰਗਾਏ ਸੀਗੇ ਜੋ ਕਿ ਮੈਂ ਕੱਲ੍ਹ ਰਿਸੀਵ ਕਰ ਲਏ ਆ ਅਤੇ ਉਹਦੇ ਉੱਪਰ ਪੈਕਿੰਗ ਦੇ ਉੱਪਰ ਬਹੁਤ ਵਧੀਆ ਲਿਖਿਆ ਗਿਆ ਸੀ ਇਹਦੇ ਉੱਪਰ ਟੁੱਟਣ ਵਾਲੀ ਚੀਜ਼ ਹੈ ਅਤੇ ਮੈਂ ਬੜੀ ਹਿਸਾਬ ਨਾਲ ਪੈਕਿੰਗ ਨੂੰ ਖੋਲ੍ਹਿਆ ਉਹਦੇ ਵਿੱਚ ਵੀ ਬੜੀ ਤਕੜੀ ਪੈਕਿੰਗ ਕੀਤੀ ਸੀਗੀ ਚੀਜ਼ ਟੁੱਟੇ ਨਾ ਅਤੇ ਬਜ਼ਾਰ ਵਿੱਚ ਉਹਦੀ ਕੀਮਤ ਜਿਹੜੀ ਸੀਗੀ ਹੈਡਫੋਨ ਦੀ ਦਸ ਹਜ਼ਾਰ ਸੀਗੀ ਅਤੇ ਔਨਲਾਈਨ ਮੈਨੂੰ ਪੰਜ ਹਜ਼ਾਰ ਦੀ ਪਈ ਇਹ ਅਤੇ ਉਹਨੂੰ ਦੇਖ ਕੇ ਮੈਨੂੰ ਬਹੁਤ ਬਹੁਤ ਚੰਗਾ ਲੱਗਾ ਅਤੇ ਮੇਰੇ ਪਰਿਵਾਰ ਨੂੰ ਵੀ ਵਧੀਆ ਲੱਗਾ ਹੁਣ ਜਿਹੜਾ ਇਹ ਮੋਬਾਈਲ 'ਤੇ ਲੋਕੇਸ਼ਨ ਵੀ ਦ ਚੁੱਕਦਾ ਆ ਹੋਰ ਵੀ ਕਈ ਇਹ 'ਚ ਫੰਕਸ਼ਨ ਆ ਬਹੁਤ ਵਧੀਆ ਫੰਕਸ਼ਨ ਇਹਦੇ ਵਿੱਚ ਅਤੇ ਮੈਨੂੰ ਤੁਹਾਡੀ ਪੈਕਿੰਗ ਜਿਹੜੀ ਇਹ ਠੀਕ ਹੋਣ ਕਰਕੇ ਜਾਂ ਇਹ ਗੱਡੀ ਜਿਹੜੀ ਸਮਾਨ ਆ ਇਹਦੇ ਹੈਡਫੋਨ ਦੀ ਅਤੇ ਹੋਣ ਕਰਕੇ ਸਹੀ ਰਿਸੀਵਿੰਗ ਹੋਣ ਕਰਕੇ ਵਧੀਆ ਲੱਗਾ ਅਤੇ ਇਹਦਾ ਰੰਗ ਵੀ ਵਧੀਆ ਲੱਗਾ ਅਤੇ ਮੈਂ ਇਹਨੂੰ ਦੇਖ ਕੇ ਆਪਣੀ ਵਾਈਫ ਨੂੰ ਵੀ ਵਾਈਫ ਦਾ ਵੀ ਇੱਕ ਔਡਰ ਹੋਰ ਦੋ ਚਾਰ ਦਿਨਾਂ ਤੱਕ ਕਰ ਦੇਵਾਂਗਾ ਮੈਂ ਤੁਹਾਡੇ ਚੀਜ਼ ਤੋਂ ਸੰਤੁਸ਼ਟ ਹਾਂ